ਖੇਡਾਂ ਦੇ ਮਹੱਤਵ ਬਾਰੇ ਪੇਂਡੂ ਲੋਕਾਂ ਦੀ ਮੁਖਬਰਾਏ ਹੈਗੀ ਹੈ ਪਰ ਲੋਕੀਂ ਬਹੁਤ ਪੁਰਾਣੇ ਸਮੇਂ ਤੋਂ ਹੀ ਪੇਂਡੂ ਖੇਡਾਂ ਚੱਲਦੀਆਂ ਹਨ ਅਤੇ ਅਜੇ ਵੀ ਲੋਕ ਹੈਗੇ ਉਹ ਪਿੰਡਾਂ ਦੀਆਂ ਖੇਡਾਂ ਹੈਗੀਆਂ ਜਿਹੜੀਆਂ ਖੇਤਰੀ ਖੇਡਾਂ ਉਹ ਖੇਡਦੇ ਹੈਗੇ ਹੈ